ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਪੋਸਟ ਕਰਨਾ ਮੈਨੂੰ ਵੈਸੇ ਚੰਗਾ ਤਾਂ ਲੱਗਦਾ ਹੈ ਅਤੇ ਪਰ ਮੇਰੇ ਕੋਲ ਕੀ ਹੈ ਕਿ ਸਮਾਂ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਕਿਉਂਕਿ ਮੈਂ ਆਪਣੀ ਪੜ੍ਹਾਈ ਵੀ ਕਰਨੀ ਹੁੰਦੀ ਹੈ ਅਤੇ ਹੋਰ ਵੀ ਕੰਮ ਵਗੈਰਾ ਕਰਦੀ ਹਾਂ ਅਤੇ ਜਿਸ ਕਰਕੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਆਪਣੀਆਂ ਸੋਸ਼ਲ ਮੀਡੀਆ 'ਤੇ ਪੋਸਟ ਵਗੈਰਾ ਕਰਾਂ ਕਦੇ ਕਦਾਰ ਇੰਸਟਾਗਰਾਮ ਫੇਸਬੁੱਕ ਜਾਂ ਫਿਰ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਂ ਤਿਆਰ ਹੋਈ ਹੋਵਾਂ ਜਾਂ ਕਿਸੇ ਤਿਉਹਾਰ ਦੇ ਉੱਤੇ ਜਾਂ ਸ਼ਾਦੀ ਦੇ ਉੱਤੇ ਅਸੀਂ ਜਾਂਦੇ ਹਾਂ ਉੱਥੇ ਤਸਵੀਰਾਂ ਖਿੱਚਦੇ ਹਾਂ ਅਤੇ ਜੋ ਤਸਵੀਰ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਜਿਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਾਂ ਇਹ ਪੋਸਟ ਕਰਨ ਵਾਲੀ ਹੈ ਮੈਂ ਉਹ ਪੋਸਟ ਕਰ ਵੀ ਦਿੰਦੀ ਹਾਂ ਤਾਂ ਕਿ ਮੇਰੇ ਨਾਲ ਜੁੜੇ ਹੋਏ ਜੋ ਮੇਰੇ ਫੋਲੋਅਰਸ ਨੇ ਜਾਂ ਫਿਰ ਮੇਰੇ ਜੋ ਦੋਸਤ ਜਾਂ ਰਿਸ਼ਤੇਦਾਰ ਨੇ ਉਹ ਫੋਟੋ ਦੇਖ ਸਕਣ ਕਿਉਂਕਿ ਮੈਨੂੰ ਵਧੀਆ ਲੱਗਦਾ ਹੈ ਕਿ ਜਦੋਂ ਕੋਈ ਕੋਂਪਲੀਮੈਂਟ ਦਿੰਦਾ ਹੈ ਕਿ ਹਾਂ ਤੁਸੀਂ ਫੋਟੋ 'ਚ ਬਹੁਤ ਸੋਹਣੇ ਲੱਗਣ ਦੇ ਹੋ ਅਤੇ ਤੁਹਾਡੀ ਫੋਟੋ ਬਹੁਤ ਸੋਹਣੀ ਆਈ ਹੈ ਮੈਨੂੰ ਵਧੀਆ ਲੱਗਦਾ ਹੈ ਜਦੋਂ ਕੋਈ ਮੈਨੂੰ ਇੱਦਾਂ ਕਮੈਂਟ ਕਰਦਾ ਹੈ ਅਤੇ ਜ਼ਿਆਦਾਤਰ ਫੋਟੋਆਂ ਮੈਂ ਉਦੋਂ ਹੀ ਖਿੱਚਦੀ ਹਾਂ ਜਦੋਂ ਮੈਂ ਕੋਈ ਤਿਉਹਾਰ 'ਤੇ ਤਿਆਰ ਹੋਈ ਹੋਵਾਂ ਉੱਦਾਂ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿਉਂਕਿ ਮੈਂ ਵਿਦਿਆਰਥੀ ਹਾਂ ਮੈਂ ਆਪਣੀ ਪੜ੍ਹਾਈ ਵੀ ਕਰਨੀ ਹੁੰਦੀ ਹੈ ਤਾਂ ਇਸ ਕਰਕੇ ਮੈਂ ਘੱਟ ਹੀ ਆਪਣੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਦੀ ਹਾਂ ਇੰਸਟਾਗਰਾਮ ਦੇ ਉੱਤੇ ਜ਼ਿਆਦਾਤਰ ਮੈਂ ਅਪਲੋਡ ਕਰਦੀ ਹਾਂ ਫੇਸਬੁੱਕ ਮੈਂ ਜ਼ਿਆਦਾ ਨਹੀਂ ਚਲਾਉਂਦੀ ਹੈਗੀ ਕਿਉਂਕਿ ਮੈਨੂੰ ਵਧੀਆ ਵੀ ਨਹੀਂ ਲੱਗਦਾ ਹੈਗਾ ਕਿਉਂਕਿ ਫੇਸਬੁੱਕ ਦੇ ਉੱਤੇ ਪ੍ਰਾਈਵੇਸੀ ਹੀ ਨਹੀਂ ਰਹਿੰਦੀ ਹੈਗੀ ਅਤੇ ਫੇਸਬੁੱਕ ਤੋਂ ਫੋਟੋਆਸ ਕੀ ਨੇ ਆਪਣੀਆਂ ਲੀਕ ਵੀ ਹੋ ਜਾਂਦੀਆਂ ਨੇ ਅਤੇ ਇੰਸਟਾਗਰਾਮ ਦੇ ਉੱਤੇ ਮੈਂ ਵੀ ਪ੍ਰਾਈਵੇਟ ਅਕਾਊਟ ਬਣਾਇਆ ਹੋਇਆ ਹੈ ਮੈਂ ਕਦੇ ਵੀ ਪਬਲਿਕ ਦੇ ਵਿੱਚ ਆਪਣੀ ਪੋਸਟ ਨਹੀਂ ਪਾਈ ਹੈਗੀ ਕਿਉਂਕਿ ਪਬਲਿਕ ਤੋਂ ਅਕਸਰ ਜਿਹੜੀਆਂ ਫੋਟੋਆਂ ਨੇ ਉਹ ਲੀਕ ਹੋ ਜਾਂਦੀਆਂ ਨੇ ਅਤੇ ਲੋਕਾਂ ਦੁਆਰਾ ਕਈ ਵਾਰੀ ਉਹ ਫੋਟੋਆਂ ਦਾ ਗਲਤ ਇਸਤੇਮਾਲ ਵੀ ਕੀਤਾ ਜਾਂਦਾ ਹੈ ਇਸ ਕਰਕੇ ਮੈਨੂੰ ਥੋੜ੍ਹਾ ਬਹੁਤ ਮੈਂ ਇਹਦੇ ਵਿਰੁੱਧ ਵੀ ਵੀ ਹਾਂ ਕਿ ਸੋਸ਼ਲ ਮੀਡੀਆ 'ਤੇ ਹਰ ਵਕਤ ਵੀ ਪੋਸਟਾਂ ਸੋਸ਼ਲ ਮੀਡੀਆ 'ਤੇ ਪੋਸਟ ਅਪਲੋਡ ਕਰਨਾ ਹਰ ਵਕਤ ਵੀ ਚੰਗੀ ਗੱਲ ਨਹੀਂ ਹੁੰਦੀ